ਮੈਂ ਸਕੂਲ ਦੇ ਐਨੁਅਲ ਫੰਕਸ਼ਨ ਵਿੱਚ ਕਈ ਵਾਰ ਹਿੱਸਾ ਲਿਆ ਹੋਇਆ ਹੈ ਅਤੇ ਉਸ ਵਿੱਚ ਮੈਂ ਡਾਂਸ ਦੀ ਪਰਫੋਰਮੈਂਸ ਕੀਤੀ ਸੀ ਉਸ ਵਿੱਚ ਸਾਨੂੰ ਫੰਕਸ਼ਨ ਤੋਂ ਕੁਛ ਦਿਨਾਂ ਪਹਿਲਾਂ ਡਾਂਸ ਦੀ ਪ੍ਰੈਕਟਿਸ ਰੀਹਰਸਲ ਕਰਵਾਈ ਜਾਂਦੀ ਸੀ ਅਤੇ ਕੁਝ ਦਿਨਾਂ ਬਾਅਦ ਪ੍ਰੋਪਰ ਕੋਸਟਿਊਮਸ ਵਗੈਰਾ ਕੱਪੜਿਆਂ ਦਾ ਸਾਈਜ ਵਗੈਰਾ ਲੈ ਕੇ ਉਹ ਦੇਖਦੇ ਸੀ ਕਿ ਕਿਹੜੇ ਕੱਪੜੇ ਪਾਣੇ ਆ ਤੇ ਕਿਹੜੇ ਕੱਪੜੇ ਨੇ ਹੀ ਪਾਉਣੇ ਮੈਨੂੰ ਇਸ ਵਿੱਚ ਬਹੁਤ ਮਜ਼ਾ ਆਉਂਦਾ ਸੀ ਵੱਖ ਵੱਖ ਟੀਚਰਸ ਪੇਰੈਂਟਸ ਦੇ ਸਾਹਮਣੇ ਡਾਂਸ ਕਰਨਾ ਪਰਫੋਰਮੈਂਸ ਕਰਨੀ ਮੈਨੂੰ ਬਹੁਤ ਚੰਗੀ ਲੱਗਦੀ ਸੀ